ਭੰਗੜੇ ਪ੍ਰਦਰਸ਼ਨ ਦੌਰਾਨ ਪੱਗੜੀ ਪਹਿਨੀ ਜਾਂਦੀ ਹੈ ਜਿਹਨੂੰ ਤੁਰਲੇ ਵਾਲੀ ਪੱਗ ਕਿਹਾ ਜਾਂਦਾ ਉਹ ਦੇ ਵਿੱਚ ਪੱਗ ਆਮ ਤਰੀਕੇ ਨਾਲ ਪੱਗ ਬੰਨ੍ਹ ਕੇ ਉਹਦੇ ਉੱਪਰ 'ਤੇ ਕਲਗੀਨੁਮਾ ਇੱਕ ਚੀਜ਼ ਬਣਾਈ ਜਾਂਦੀ ਹੈ ਅਤੇ ਉਸ ਤੋਂ ਇਲਾਵਾ ਉੱਪਰ ਇੱਕ ਝੱਗਾ ਜਾਂ ਕਮੀਜ਼ ਕਹਿ ਸਕਦੇ ਹਾਂ ਉਹ ਪਾਈ ਜਾਂਦੀ ਹੈ ਝੱਗੀ ਕਹਿ ਦਿੰਦੇ ਝੱਗਾ ਕਹਿ ਦਿੰਦੇ ਅਤੇ ਜੇ ਕਮੀਜ਼ ਪੂਰੀਆਂ ਬਾਹਾਂ ਵਾਲੀ ਪਾਈ ਹੋਵੇ ਤਾਂ ਉੱਪਰ ਇੱਕ ਛੋਟੀ ਜਿਹੀ ਝੱਗੀ ਜਾਂ ਬਾਸਕਿੱਟ ਜੋ ਕਿਹਾ ਜਾਂਦਾ ਉਹ ਪਾ ਦਿੱਤੀ ਜਾਂਦੀ ਹੈ ਇੱਕ ਮੋਸਟਲੀ ਇਹ ਹੁੰਦੀ ਕਿ ਸੂਤੀ ਕੱਪੜੇ ਦੀ ਹੋਣੀ ਚਾਹੀਦੀ ਜਾਂ ਫਿਰ ਕੋਟਨ ਦੀ ਵੀ ਜਾਂ ਹੋ ਸਕਦੀ ਹੈ ਉਹਦੇ ਇਲਾਵਾ ਰੇਸ਼ਮੀ ਕੱਪੜੇ ਦੀ ਵੀ ਬਣ ਸਕਦੀ ਹੈ ਪਰ ਇਹ ਨਾ ਬਹੁਤ ਖਰਚ ਖਰਚਾ ਇਹਨਾਂ ਚੀਜ਼ਾਂ ਪਰ ਕਦ ਕੀਤਾ ਨਹੀਂ ਜਾ ਸਕਦਾ ਉਹਦੇ ਇਲਾਵਾ ਜਿੰਨੀ ਜੇ ਰੇਸ਼ਮੀ ਕੱਪੜੇ ਹੋਣ ਤਾਂ ਉਨ੍ਹਾਂ ਕਿਆ ਚੀਜ਼ ਆਕਰਸ਼ਿਤ ਬਣ ਜਾਂਦੀ ਥੋੜ੍ਹਾ ਜਿਹਾ ਕੱਪੜੇ ਦਾ ਆਕਰਸ਼ਿਤ ਕਰਦਾ ਬੱਚੇ ਨੂੰ ਜਦ ਇੱਕ ਭੰਗੜਾ ਵੇਖਣੇ ਵਾਲੇ ਨੂੰ ਉਹ ਥੱਲੇ ਥੱਲੇ ਧੋਤੀਨੁਮਾ ਇੱਕ ਪ ਬੰਨ੍ਹੀ ਜਾਂਦੀ ਹੈ ਜਾਂ ਕੁੜਤਾ ਪਜਾਮਾ ਵੀ ਕਈ ਹਲਾਤਾਂ ਵਿੱਚ ਯੂਸ ਕਰ ਲਿਆ ਜਾਂਦਾ ਹੈ ਉਹਦੇ ਨਾਲ ਕਿਆ ਹੋਣਾ ਸਭ ਤੋਂ ਬੜੀ ਖਰਚੇ ਕਰਨ ਵਾਲੀ ਚੀਜ਼ ਹੁੰਦੀ ਭੰਗੜੇ ਪਾਉਣੇ ਵਾਲੇ ਦਾ ਭੰਗੜਾ ਭੰਗੜੇ ਪਾਉਣੇ ਭੰਗੜੇ ਪਾਉਣ ਨਾਲ ਕਿਆ ਹੋਣਾ ਉਹ ਪੁਸ਼ਾਕਾਂ ਹੋਰ ਉੱਭਰ ਕੇ ਆਉਂਦੀਆਂ ਰਸਤਾ ਸੋਹਣਾ ਲੱਗਦਾ ਉਹ ਅਤੇ ਉਹ ਤੋਂ ਬਾਅਦ ਕੋਂਫੀਡੈਂਸ ਜੇ ਕੋਂਫੀਡੈਂਸ ਹੁੰਦਾ ਕੱਪੜੇ ਹਰੇਕ ਤਰ੍ਹਾਂ ਤੁਹਾਨੂੰ ਜੱਚਦੇ ਅਤੇ ਪੁਸ਼ਾਕਾਂ ਵਿੱਚ ਕੁੜੀਆਂ ਜਿਹੜੀਆਂ ਉਹ ਇੱਕ ਤਰ੍ਹਾਂ ਦੀ ਝੱਗੀਆਂ ਅਤੇ ਉਹ ਵੀ ਕਮੀਜ਼ਾਂ ਪਰੰਡ ਘੱਗਰਾ ਟਾਈਪ ਯੂਸ ਕਰ ਲੈਂਦੀਆਂ ਜਿਹੜੀ ਕਿ ਪੁਰਾਣੇ ਟੈਮ ਵਿੱਚ ਭੰਗੜੇ ਦੀ ਸਾਡੀ ਪੁਸ਼ਾ ਪੰਜਾਬੀ ਪੁਸ਼ਾਕ ਹੁੰਦੀ ਸੀ ਇਹਦੇ ਨਾਲ ਹੀ ਅਸੀਂ ਕੈਂਠਾ ਪਾ ਲੈਂਦੇ ਹੈ ਮੁੰਡੇ ਅਤੇ ਕੁੜੀਆਂ ਹੋਰ ਓਰਨਾਮੈਂਟ ਜਾਂ ਕੋਈ ਗਹਿਣੇ ਪਾ ਲੈਂਦੀਆਂ ਹੈ ਕੈਂਠਾ ਬਹੁਤ ਕੰਨਾਂ ਪਰ ਕੰਨਾਂ ਵਿੱਚ ਵਾਲੀਆਂ ਝੁਮਕੇ ਪਾ ਲੈਂਦੀਆਂ ਅਤੇ ਮੁੰਡੇ ਆਪਣੇ ਡੋਲਿਆਂ 'ਤੇ ਬਾਹਾਂ ਪਰ ਬਾਜ਼ੂਬੰਦ ਜਿਹਨੂੰ ਕਹਿੰਦੇ ਉਸ ਤਰੀਕੇ ਦਾ ਪਾ ਲਿਆ ਜਾਂਦਾ ਇਹ ਚੀਜ਼ ਨਾਲ ਥੱਲੇ ਪੈਰਾਂ 'ਚ ਜੁੱਤੀ ਪੰਜਾਬੀ ਜੁੱਤੀ ਜਿਹਨੂੰ ਕਹਿੰਦੇ ਕੁੜੀਆਂ ਪੰਜਾਬੀ ਜੁੱਤੀ ਪਾ ਲੈਂਦੀਆਂ ਹਾਂਜੀ